ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਤੁਸੀਂ ਹਰਮਨ ਸਿੰਘ ਬੋਲ ਰਹੇ ਹੋ ਕੈਬ ਡਰਾਈਵਰ ਹਾਂਜੀ ਭਾਅ ਜੀ ਭਾਅ ਜੀ ਮੇਰੀ ਨਾ ਕੈਬ ਬੁੱਕ ਸੀ ਇੱਧਰੋਂ ਨਿਊ ਪ੍ਰਤਾਪ ਨਗਰ ਤੋਂ ਏਅਰਪੋਰਟ ਤੱਕ ਦੀ ਹਾਂਜੀ ਭਾਅ ਜੀ ਭਾਅ ਜੀ ਇੰਨਾ ਟਾਈਮ ਕਿਉਂ ਲੱਗ ਰਿਹਾ ਭਾਅ ਜੀ ਮੇਰੀ ਸਾਢੇ ਦਸ ਵਜੇ ਦੀ ਫਲਾਈਟ ਹੈ ਸੋ ਤੁਸੀਂ ਟਾਈਮ ਦੇਖੋ ਕਿੰਨਾ ਅੱਠ ਵੱਜ ਗਏ ਨੇ ਮੈਂ ਚੈਕਿੰਗ ਵੀ ਕਰਨਾ ਲੇਟ ਹੋ ਜਾਣਾ ਤੁਸੀਂ ਆ ਕਿਉਂ ਨਹੀਂ ਰਹੇ ਤੁਹਾਨੂੰ ਸਰ ਪੈਸੇ ਵੀ ਪਹਿਲਾਂ ਪਹੁੰਚ ਗਏ ਸਭ ਕੁਛ ਪਹਿਲਾਂ ਹੀ ਬੁੱਕ ਹੋਇਆ ਪਿਆ ਕੀ ਗੱਲ ਕੀ ਭਾਅ ਜੀ ਦੱਸੋਂਗੇ ਕੁਛ ਅੱਛਾ ਭਾਅ ਜੀ ਟਰੈਫਿਕ 'ਚ ਫਸੇ ਜੇ ਹੋ ਭਾਅ ਜੀ ਮੇਰੀ ਗੱਲ ਸਮਝੋ ਮੈਂ ਮੰਨਦਾ ਤੁਸੀਂ ਟਰੈਫਿਕ 'ਚ ਫਸੇ ਜੇ ਮੇਰਾ ਭਰਾ ਮੇਰਾ ਵੀ ਜ਼ਰੂਰੀ ਜਾਣਾ ਮੈਂ ਉੱਥੇ ਜਾਣਾ ਅੱਗੇ ਮੇਰੀ ਮੀਟਿੰਗ ਆ ਭਾਅ ਜੀ ਫਲਾਈਟ ਕੈਂਸਲ ਹੋ ਗਈ ਤਾਂ ਉਹਦੇ ਪੈਸੇ ਵੀ ਮੈਨੂੰ ਦੁਬਾਰਾ ਭਰਨੇ ਪੈਣੇ ਹੈ ਭਾਅ ਜੀ ਇਹ ਵੀ ਤੁਸੀਂ ਦੇਖੋ ਨਾ ਥੋੜ੍ਹਾ ਜਲਦੀ ਕਰ ਲਉ ਜੇ ਤੁਹਾਡੇ ਕੋਲ ਨਹੀਂ ਆਇਆ ਜਾਣਾ ਤੁਸੀਂ ਆਪਣੇ ਕਿਸੇ ਪਾਰਟਨਰ ਦਾ ਜਾਂ ਆਪਣੇ ਤੁਹਾਡੇ ਆਪਣੇ ਸਾਥੀ ਦਾ ਨੰਬਰ ਦੇ ਦਿਉ ਜਿਹੜਾ ਕੈਬ ਲੈ ਕੇ ਆ ਸਕਦਾ ਹਾਂ ਉਹਨੂੰ ਬੁਲਾ ਦਿਉ ਮੈਂ ਉਹਦੇ ਨਾਲ ਚੱਲ ਜਾਂਗਾ ਭਾਅ ਜੀ ਕਰਨਾ ਤਾਂ ਪੈਣਾ ਮੈਨੂੰ ਕੁਛ ਨਾ ਕੁਛ ਦੱਸੋ ਫਿਰ ਭਾਅ ਜੀ ਕਿੱਦਾਂ ਕਰਨਾ ਨਹੀਂ ਤਾਂ ਫਿਰ ਮੈਂ ਭਾਅ ਜੀ ਕੰਮ ਕਰਦਾ ਹਾਂ ਆਟੋ ਬੁੱਕ ਕਰ ਲੈਂਦਾ ਹਾਂ ਹੁਣ ਉਹ 'ਤੇ ਚੱਲ ਜਾਂਦਾ ਹਾਂ ਅਤੇ ਜਿਹੜੇ ਮੇਰੇ ਪੈਸੇ ਆ ਉਹ ਮੈਂ ਕੈਂਸਲ ਕਰ ਦਿੰਦਾ ਮੈਨੂੰ ਔਨਲਾਈਨ ਵਾਪਸ ਆ ਜਾਣਗੇ ਅੱਛਾ ਭਾਅ ਜੀ ਤੁਸੀਂ ਆ ਰਹੇ ਹੋ ਭਾਅ ਜੀ ਕਿੰਨਾ ਕੁ ਟਾਈਮ ਲਾਉਂਗੇ ਮੈਨੂੰ ਦੱਸ ਦਿਉ ਮੈਂ ਫਿਰ ਭਾਅ ਜੀ ਇੱਕ ਮਿੰਟ ਜਿੰਨਾ ਵੀ ਤੁਸੀਂ ਲਾਉਣਾ ਵਾ ਮੈਂ ਵੇਟ ਕਰ ਰਿਹਾਂ ਦਸ ਕੁ ਮਿੰਟ ਲੱਗਣਗੇ ਭਾਅ ਜੀ ਥੋੜ੍ਹਾ ਜਲਦੀ ਕਰ ਲਓ ਮੈਂ ਜਾਣਾ ਵਾ ਤੁਹਾਨੂੰ ਦਸ ਦੱਸ ਤਾਂ ਚੁੱਕਾ ਹਾਂ ਭਾਅ ਜੀ ਚੰਗੇ ਨਹੀਂ ਲੱਗੀਦਾ ਇੱਦਾਂ ਦੇ ਕੰਮ ਕਰਦੇ ਹੋਏ ਮੈਂ ਬਹੁਤ ਲੇਟ ਹੋ ਜਾਣਾ ਵਾ ਥੋੜ੍ਹਾ ਜਲਦੀ ਕਰੋ ਫਿਰ ਜਾਂ ਫਿਰ ਇੱਕ ਕੰਮ ਕਰੋ ਤੁਸੀਂ ਆਪਣਾ ਨੰਬਰ ਦੇ ਦਿਉ ਕਿਸੇ ਹੋਰ ਬੰਦੇ ਦਾ ਅੱਛਾ ਕੀ ਨਾਮ ਉਹਦਾ ਸਰ ਅੱਛਾ ਪਰਮਜੀਤ ਨਾਂ ਉਹਦਾ ਕੀ ਉਹਨੂੰ ਕਹਿ ਰਹੇ ਔਰ ਨੰਬਰ ਬੋਲ ਦਿਉ ਅੱਛਾ ਅਠਾਨਵੇਂ ਅਠਾਸੀ ਬਿਆਸੀ ਛੱਤੀ ਬਵੰਜਾ ਠੀਕ ਆ ਭਾਅ ਜੀ ਮੈਂ ਫੋਨ ਕਰ ਲੈਂਦਾ ਬਾਕੀ ਪੁੱਛ ਲੈਨਾ ਕੀ ਕਹਿੰਦੇ ਜੇ ਠੀਕ ਆ ਜੀ ਧੰਨਵਾਦ ਭਾਅ ਜੀ ਧੰਨਵਾਦ